ਦੋ ਅਕਤੂਬਰ ਉੱਨੀ ਸੌ ਬਹੱਤਰ ਦਸ ਜੂਨ ਉੱਨੀ ਸੌ ਸਤੱਨਵੇ ਸਤਾਰਾਂ ਅਗਸਤ ਦੋ ਹਜ਼ਾਰ ਚਾਰ ਸੱਤ ਸਤੰਬਰ ਉੱਨੀ ਸੌ ਕਹੱਤਰ ਦਸ ਅਕਤੂਬਰ ਉੱਨੀ ਸੌ ਨੱਬੇ